ਰੂਪਨਗਰ ਵਿੱਚ ਵੈਸੇ ਤਾਂ ਬਹੁਤ ਸੁਵਿਧਾਵਾਂ ਹਨ ਲੇਕਿਨ ਸਭ ਤੋਂ ਜ਼ਿਆਦਾ ਮਨੋਰੰਜਕ ਸੁਵਿਧਾ ਅਸੀਂ ਮੂਵੀ ਥੀਏਟਰ ਦੇਖ ਸਕਦੇ ਹਨ ਅਤੇ ਨਾਲ਼ ਹੀ ਨਾਲ਼ ਉਰੇ ਕਾਫ਼ੀ ਜ਼ਿਆਦਾ ਪਾਰਕ ਅਤੇ ਮਿਊਜ਼ੀਅਮ ਵੀ ਪਾਏ ਜਾਂਦੇ ਹਨ ਜਿੱਥੇ ਕਿ ਜਾ ਜਾ ਕੇ ਲੋਕ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਨ ਅਤੇ ਨਵੀਂ ਨਵੀਂ ਜਗ੍ਹਾ ਦੀ ਖੋਜ ਕਰ ਸਕਦੇ ਹਨ